ਹਰੇਕ ਮਨੁੱਖ ਦਾ ਆਪਣਾ ਵੱਖਰਾ ਵੱਖਰਾ ਸੁਭਾਅ ਹੁੰਦਾ ਆ ਕੁਝ ਲੋਕ ਉਸੇ ਕੰਮ ਨੂੰ ਕੰਮ ਤੋਂ ਡਰਦੇ ਹੀ ਰਹਿ ਜਾਂਦੇ ਹਨ ਅਤੇ ਕੁਝ ਉਹੀ ਕੰਮ ਕਰਕੇ ਜ਼ਿੰਦਗੀ ਵਿੱਚ ਇੱਕ ਚੰਗਾ ਮੁਕਾਮ ਹਾਸਿਲ ਕਰ ਲੈਂਦੇ ਆ ਜਿਵੇਂ ਉਚਾਈ 'ਤੇ ਚੜ੍ਹਨਾ ਨੂੰ ਲੈਂਦੇ ਹਾਂ ਕੁਝ ਇਨਸਾਨਾਂ ਨੂੰ ਉਚਾਈ 'ਤੇ ਚੜ੍ਹਨ ਤੋਂ ਬਹੁਤ ਡਰ ਲੱਗਦਾ ਆ ਅਤੇ ਕੁਝ ਲੋਕ ਅਜਿਹੇ ਹਨ ਜਿਵੇਂ ਕਿ ਪਹਾੜਾਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਚੜ੍ਹ ਕੇ ਦੇਸ਼ ਦਾ ਅਤੇ ਆਪਣਾ ਨਾਮ ਰੌਸ਼ਨ ਕੀਤਾ ਆ ਔਰ ਮੈਨੂੰ ਹੀ ਚੜ੍ਹਾਈ ਤੋਂ ਪਹਿਲਾਂ ਤਾਂ ਬਹੁਤ ਡਰ ਲੱਗਦਾ ਸੀ ਜਿਵੇਂ ਇੱਕ ਵਾਰ ਅਸੀਂ ਹਿਮਾਚਲ ਵਿੱਚ ਮੰਡੀ ਤੋਂ ਅੱਗੇ ਕੁੱਲੂ ਸ਼ਹਿਰ ਹੈ ਉੱਥੇ ਜਾਣਾ ਸੀ ਜਿਉਂ ਜਿਉਂ ਬਸ ਅੱਗੇ ਪਹਾੜਾਂ ਵਿੱਚ ਜਾਂਦੀ ਮੇਰੇ ਦਿਲ ਦੀ ਧੜਕਨ ਹੋਰ ਤੇਜ਼ ਹੋ ਜਾਂਦੀ ਕਿਉਂਕਿ ਮੈਂ ਕਦੇ ਇੰਨੀ ਉੱਚਾਈ 'ਤੇ ਨਹੀਂ ਸੀ ਗਿਆ ਫਿਰ ਹੌਲੀ ਹੌਲੀ ਮੈਨੂੰ ਸਾਰਿਆਂ ਨੇ ਹੌਂਸਲਾ ਦਿੱਤਾ ਅਤੇ ਫਿਰ ਮੈਂ ਬੱਚਿਆਂ ਵੱਲ ਦੇਖਿਆ ਕਿ ਉਹ ਤਾਂ ਡਰ ਨਹੀਂ ਰਹੇ ਸਗੋਂ ਮੁਸਕਰਾ ਰਹੇ ਹਨ ਮੇਰੇ ਮਨ ਵਿੱਚ ਵੀ ਡਰ ਥੋੜ੍ਹਾ ਜਿਹਾ ਲੱਥ ਗਿਆ ਅਤੇ ਮੈਂ ਅਗਲੀ ਚੜ੍ਹਾਈ ਅੱਗੇ ਬੱਸ 'ਤੇ ਅੱਗੇ ਬੈਠ ਕੇ ਬੜੇ ਆਰਾਮ ਨਾਲ ਕੀਤੀ ਤੋਂ ਇਸੇ ਤਰ੍ਹਾਂ ਹੀ ਇੱਕ ਵਾਰ ਦੀ ਗੱਲ ਹੈ ਕਿ ਮੈਂ ਜਿੱਥੇ ਕੰਮ ਕਰਦਾ ਆ ਉੱਥੇ ਮੇਰੇ ਬੋਸ ਨੇ ਮੈਨੂੰ ਕਿਹਾ ਕਿ ਬਈ ਆਹ ਉੱਪਰ ਤੀਸਰੀ ਮੰਜ਼ਲ ਆ ਉਹ ਕੋਲਮ 'ਤੇ ਚੜ੍ਹ ਕੇ ਜਾਣਾ ਆ ਉੱਪਰ ਲੇਕਿਨ ਉਹ ਸਿੱਧਾ ਕੋਲਮ ਹੋਣ ਕਰਕੇ ਮੇਰੇ ਕੋਲੋਂ ਉਸ ਉੱਚਾਈ 'ਤੇ ਨਹੀਂ ਚੜ੍ਹਿਆ ਗਿਆ ਔਰ ਮੇਰਾ ਬੌਸ ਉਸੇ ਚੜ੍ਹਾਈ 'ਤੇ ਫਟਾਫਟ ਤਾਂ ਉੱਪਰ ਚੜ੍ਹ ਗਿਆ ਔਰ ਮੈਨੂੰ ਉਸ ਨੇ ਫਿਰ ਕਿਹਾ ਕਿ ਤੂੰ ਉੱਪਰ ਆ ਮੈਂ ਕਿਹਾ ਨਹੀਂ ਸਰ ਮੇਰੇ ਕੋਲ ਉੱਪਰ ਨਹੀਂ ਆਇਆ ਜਾਣਾ ਬਹੁਤ ਮੁਸ਼ਕਿਲ ਹੈ ਮੈਨੂੰ ਡਰ ਲੱਗਦਾ ਹੈ ਉੱਪਰ ਉੱਚਾਈ ਤੋਂ ਕਹਿੰਦੇ ਨਹੀਂ ਕੁਛ ਹੁੰਦਾ ਤੂੰ ਉੱਪਰ ਆ ਫਿਰ ਮੈਂ ਥੋੜ੍ਹਾ ਜਿਹਾ ਹੌਂਸਲਾ ਕਰਕੇ ਤਾਂ ਕੋਲਮ ਰਾਹੀਂ ਪਹਿਲੇ ਫਲੋਰ ਤੱਕ ਗਿਆ ਪਹਿਲੇ ਫਲੋਰ 'ਤੇ ਜਾ ਕੇ ਮੇਰਾ ਥੋੜ੍ਹਾ ਜਿਹਾ ਹੌਂਸਲਾ ਵਧਿਆ ਕਿ ਨਹੀਂ ਮੈਂ ਪਹਿਲੇ ਫਲੋਰ ' ਤੇ ਆ ਗਿਆ ਹਾਂ ਹੁਣ ਮੈਂ ਹੋਰ ਉੱਪਰ ਵੀ ਜਾ ਸਕਦਾ ਹਾਂ ਫਿਰ ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਹੋਰ ਕੀਤੀ ਅਤੇ ਮੈਂ ਦੂਸਰੇ ਫਲੋਰ 'ਤੇ ਵੀ ਚਲਾ ਗਿਆ ਅਤੇ ਮੈਨੂੰ ਡਰ ਤਾਂ ਲੱਗੇ ਲੇਕਿਨ ਥੋੜ੍ਹਾ ਜਿਹਾ ਮਨ 'ਚ ਹੌਂਸਲਾ ਹੋਇਆ ਕਿ ਨਹੀਂ ਮੈਂ ਹੋਰ ਉੱਪਰ ਵੀ ਜਾ ਸਕਦਾ ਹਾਂ ਸੋ ਬੌਸ ਮੇਰੇ ਨੇ ਫਿਰ ਮੈਨੂੰ ਕਿਹਾ ਕਿ ਤੂੰ ਉੱਪਰ ਆ ਹੋਰ ਉੱਪਰ ਆ ਫਿਰ ਮੈਂ ਕੋਲਮ 'ਤੇ ਚੜ੍ਹ ਕੇ ਅਤੇ ਹੋਰ ਉੱਪਰ ਗਿਆ ਅਤੇ ਮੇਰਾ ਹੌਂਸਲਾ ਵੱਧ ਗਿਆ ਕਿ ਨਹੀਂ ਮੈਂ ਇਸ ਉੱਚਾਈ 'ਤੇ ਵੀ ਜਾ ਸਕਦਾ ਹਾਂ ਸੋ ਇਸੇ ਤਰ੍ਹਾਂ ਹੀ ਆ ਕਿ ਅਗਰ ਅਸੀਂ ਉੱਚਾਈਆਂ ਤੋਂ ਡਰਦੇ ਰਵਾਂਗੇ ਤਾਂ ਅਸੀਂ ਉੱਚਾਈ 'ਤੇ ਕਦੇ ਪਹੁੰਚ ਨਹੀਂ ਪਾਵਾਂਗੇ ਸੋ ਸਾਨੂੰ ਇਹਨਾਂ ਉੱਚਾਈਆਂ ਤੋਂ ਨਹੀਂ ਡਰਨਾ ਚਾਹੀਦਾ ਜੇ ਦੂਸਰੇ ਲੋਕ ਉੱਚਾਈਆਂ 'ਤੇ ਜਾ ਸਕਦੇ ਹਨ ਤਾਂ ਸਾਨੂੰ ਕੀ ਹੋਇਆ ਆ ਅਸੀਂ ਵੀ ਜਾ ਸਕਦੇ ਹਾਂ ਔਰ ਹੌਂਸਲਾ ਰੱਖ ਕੇ ਆਪਾਂ ਇਸ ਉੱਚਾਈ ਨੂੰ ਪਾਰ ਕਰ ਸਕਦੇ ਹਾਂ